ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਭਾਸ਼ਾ ਬਹੁਤ ਹੀ ਮਹੱਤਵਪੂਰਨ ਆ ਜੋ ਕਿ ਮੇਰੀ ਮਾਂ ਬੋਲੀ ਆ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਪੰਜਾਬੀ ਭਾਸ਼ਾ ਨੂੰ ਬੋਲਣਾ ਅਤੇ ਸੁਣਨਾ ਪਸੰਦ ਕਰਦਾ ਵਾ ਅਤੇ ਅੱਜ ਕੱਲ੍ਹ ਹਰ ਕੋਈ ਸਮਝ ਵੀ ਲੈਂਦਾ ਆ ਆਸਾਨੀ ਦੇ ਨਾਲ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਪ ਲੋਕ ਪੰਜਾਬ ਤੋਂ ਵਿਦੇਸ਼ਾਂ ਵਿੱਚ ਗਏ ਨੇ ਜਿੱਥੇ ਕਿ ਪੰਜਾਬੀ ਭਾਸ਼ਾ ਨੂੰ ਹੀ ਵਰਤਦੇ ਆ ਅਤੇ ਦੂਜੇ ਲੋਕ ਸਮਝ ਵੀ ਲੈਂਦੇ ਆ ਪੰਜਾਬੀ ਗਾਣਿਆਂ ਦੇ ਵਿੱਚ ਵੀ ਜਿਹੜੇ ਪੰਜਾਬੀ ਗਾਣੇ ਸੁਣਨੇ ਅਤੇ ਬੋਲਣੇ ਵੀ ਬਹੁਤ ਪਸੰਦ ਆ ਪੰਜਾਬੀ ਭੰਗੜਾ ਵੀ ਬਹੁਤ ਪਸੰਦ ਆ ਵੇਖਣ 'ਚ ਅਤੇ ਪਹੁੰਚ ਦੋਵਾਂ ਦੇ ਵਿੱਚ ਹੀ ਆਨੰਦ ਆਉਂਦਾ ਵਾ ਅੱਜ ਕੱਲ੍ਹ ਪੰਜਾਬੀ ਗਾਣਿਆਂ ਤੋਂ ਲੋਕ ਬਹੁਤ ਮੋਟੀਵੇਟ ਹੁੰਦੇ ਆ ਅਤੇ ਬਹੁਤ ਹੀ ਪੰਜਾਬੀ ਕਥਾਵਾਂ ਕਵਿਤਾਵਾਂ ਅਤੇ ਸਟੋਰੀਆਂ ਲੇਖ ਸਨ ਜਿਹਨਾਂ ਤੋਂ ਸਾਨੂੰ ਬਹੁਤ ਪ੍ਰੇਰਨਾ ਮਿਲਦੀ ਆ ਜਿਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਅੱਜ ਕੱਲ੍ਹ ਪੰਜਾਬੀ ਭਾਸ਼ਾ ਦਾ ਬਹੁਤ ਜ਼ਿਆਦਾ ਵਿਕਾਸ ਹੋ ਚੁੱਕਿਆ ਕਿਸੇ ਨੂੰ ਵੀ ਕੋਈ ਸ਼ਰਮ ਨਹੀਂ ਆਉਂਦੀ ਪੰਜਾਬੀ ਵਿੱਚ ਗੱਲ ਕਰਨ ਦੇ ਵਿੱਚ ਅੱਜ ਕੱਲ੍ਹ ਨੋਰਮਲੀ ਹਰ ਕੋਈ ਜਗ੍ਹਾ 'ਤੇ ਪੰਜਾਬੀ ਭਾਸ਼ਾ ਨੂੰ ਸੁਣਿਆ ਅਤੇ ਬੋਲਿਆ ਜਾਂਦਾ ਆ